ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਬੋਲੋ ਓਕੇ ਮੈਮ ਹਾਂਜੀ ਕਰੋ ਜੀ ਓਕੇ ਜੀ ਓਕੇ ਜੀ ਹਾਂਜੀ ਜੀ ਉਹ ਤਾਂ ਮੈਮ ਜਿਹੜੇ ਬਣੇ ਹੋਏ ਨੇ ਰੂਮਸ ਉਹਨਾਂ ਨੂੰ ਤਾਂ ਆਪਾਂ ਛੇੜ ਨਹੀਂ ਨਾ ਸਕਦੇ ਹੁਣ ਉਹਨਾਂ ਦੀ ਕੰਸਟਰਕਸ਼ਨ ਜੋ ਹੋਈ ਹੋਈ ਹੈ ਕੋਈ ਗੱਲ ਨਹੀਂ ਮੈਂ ਆਪਣੇ ਮੈਨੇਜਮੈਂਟ ਨਾਲ਼ ਗੱਲ ਕਰ ਲਵਾਂਗੀ ਅਤੇ ਫਿਰ ਫਰਦਰ ਜੋ ਵੀ ਉਹਨਾਂ ਦਾ ਫੈਸਲਾ ਹੋਏਗਾ ਤੁਹਾਨੂੰ ਦੱਸ ਦਿੱਤਾ ਜਾਏਗਾ ਜੋ ਵੀ ਸੁਧਾਰ ਕਰਨੇ ਹੋਣਗੇ ਅਸੀਂ ਆਪਣੇ ਲੈਵਲ 'ਤੇ ਕਰ ਦੇਵਾਂਗੇ ਜੀ ਓਕੇ ਹਾਂਜੀ ਠੀਕ ਹੈ ਜੀ ਤੁਸੀਂ ਯੂਨੀਵਰਸਿਟੀ ਦੀ ਮੇਲ ਆਈ ਡੀ 'ਤੇ ਆਪਣਾ ਜੋ ਵੀ ਹੈ ਤੁਹਾਡੀ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਮੇਲ ਕਰ ਦਿਓ

ਓਕੇ ਓਕੇ ਮੈਮ ਓਕੇ ਓਕੇ ਓਕੇ ਮੈਮ ਥੈਂਕ ਥੈਂਕ ਯੂ